ਵੈਸੇ ਤਾਂ ਮੈਂ ਕਾਫ਼ੀ ਸਾਰੀਆਂ ਕਿਤਾਬਾਂ ਨੂੰ ਪੜ੍ਹਨ ਦੇ ਵਿੱਚ ਰੁਚੀ ਰੱਖਦੀ ਹਾਂ ਮੈਂ ਖੁਦ ਇੰਜੀਨੀਅਰਿੰਗ ਦੀ ਸਟੂਡੈਂਟ ਹਾਂ ਔਰ ਮੈਂ ਕਾਫ਼ੀ ਸਾਰੀ ਬੁੱਕਸ ਨੂੰ ਰੀਡ ਕਰਦੀ ਹਾਂ ਪਰ ਉਹਨਾਂ ਵਿੱਚੋ ਜਿਹੜਾ ਭੌਤਿਕ ਕਿਤਾਬਾਂ ਜਿਵੇਂ ਇਲੈਕਟਰੋਨਿਕ ਸੰਸਕਰਨਾਂ ਨੂੰ ਜਿਹੜਾ ਪੜ੍ਹਨਾ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਕਿਉੰਕਿ ਇਹਨਾਂ ਇਲੈਕਟਰੋਨਿਕ ਸੰਸਕਰਨਾਂ ਵਿੱਚ ਸਾਨੂੰ ਜਿਹੜੀਆਂ ਇਲੈਕਟਰੋਨਿਕ ਚੀਜਾਂ ਬਾਰੇ ਨੋਲੇਜ ਗੇਨ ਹੁੰਦੀ ਹੈ ਕਿ ਮਤਲਬ ਕਿੱਦਾਂ ਜਿਹੜੇ ਹੈ ਇਲੈਕਟਰੋਨਿਕਸ ਜਿਹੜੇ ਆ ਉਹ ਸਾਡੇ ਲਈ ਜਿਹੜਾ ਵਰਕ ਕਰ ਸ ਕਰਿਆ ਕਰਦੇ ਆ ਔਰ ਜਿਹੜੀਆਂ ਭੌਤਿਕ ਕਿਤਾਬਾਂ ਉਹਨਾਂ ਵਿੱਚ ਸਾਨੂੰ ਜਿਹੜੀ ਆ ਫਿਜੀਕਲ ਚੀਜ਼ਾਂ ਬਾਰੇ ਪਤਾ ਚਲਦਾ ਹੈ ਕਿ ਕੀ ਸਾਡੇ ਆਸ ਪਾਸ ਜਿਹੜਾ ਉਹ ਹੋ ਰਿਹਾ ਮੈਂ ਕਾਫ਼ੀ ਜ਼ਿਆਦਾ ਔਡੀਓ ਬੁੱਕਸ ਜਿਹੜੀਆਂ ਉਹ ਔਨਲਾਈਨ ਵਗੈਰਾ ਸੁਣਦੀ ਰਹਿੰਦੀ ਹਾਂ ਜਿਵੇਂ ਕਿ ਯੂਟਿਊਬ ਵਗੈਰਾ 'ਤੇ ਸੁਣਦੀ ਹਾਂ ਔਰ ਮਤਲਬ ਗੂਗਲ ਵਗੈਰਾ 'ਤੇ ਕਈ ਸਾਰੇ ਜਿਹੜੇ ਐਪਸ ਆ ਉਹ ਵੀ ਹਨ ਜਿਹੜੀ ਕਿ ਬੁੱਕਸ ਨੂੰ ਜਿਹੜਾ ਉਹ ਮਤਲਬ ਔਡੀਓ ਦੇ ਰੂਪ ਪੂਰੀ ਬੁੱਕ ਨੂੰ ਜਿਹੜਾ ਔਡੀਓ ਦੇ ਰੂਪ ਵਿੱਚ ਜਿਹੜਾ ਉਹ ਸੁਣਾਉਂਦੇ ਆ ਉਹ ਸਾਰੇ ਐਪ ਵੀ ਮੈਂ ਕਾਫ਼ੀ ਯੂਜ ਕਰਦੀ ਹਾਂ ਇਹ ਮੈਨੂੰ ਜੇ ਜਿਹੜੀ ਹਨ ਇਹ ਵਾਲੀ ਚੀਜ਼ਾਂ ਨਾਲ ਜਿਹੜੀ ਹੈ ਉਹ ਕਾਫ਼ੀ ਜ਼ਿਆਦਾ ਨੌਲੇਜ ਗੇਨ ਹੁੰਦੀ ਆ ਧੰਨਵਾਦ